ਮੰਚ ਉੱਤੇ ਰੰਗੀਨ ਪਹਿਰਾਵੇ ਵਿੱਚ ਸੱਜੇ ਹੋਏ ਗੱਭਰੂ ਜੋਸ਼ ਨਾਲ ਭੰਗੜਾ ਪਾ ਰਹੇ ਹਨ ਉਹਨਾਂ ਦੇ ਪੈਰਾਂ ਦੀ ਥਾਪ ਧਰਤੀ ਨੂੰ ਹਿਲਾ ਰਹੀ ਹੈ ਜਦ ਕਿ ਢੋਲ ਦੀ ਥਾਪ ਸਰੀਰ ਵਿੱਚ ਜੋਸ਼ ਭਰ ਰਹੀ ਹੈ ਹਰੇਕ ਗੱਭਰੂ ਅਤੇ ਹੱਥ ਵਿੱਚ ਰੰਗ ਬਰੰਗੀ ਚੁੰਨੀ ਹਵਾ ਵਿੱਚ ਲਹਿਰਾਉਂਦੀ ਹੋਈ ਜਿਵੇਂ ਪੰਛੀ ਖੰਭ ਫੈਲਾ ਰਹੇ ਫੈਲਾ ਕੇ ਉੱਡ ਰਹੇ ਹੋਣ ਉਹਨਾਂ ਦੇ ਚਿਹਰਿਆਂ ਉੱਤੇ ਖੁਸ਼ੀ ਦੀ ਲਾਲੀ ਛਾਈ ਹੋਈ ਹੈ ਤੇ ਅੱਖਾਂ ਵਿੱਚ ਚਮਕ ਕੁਝ ਗੱਭਰੂ ਝੁੰਮਰ ਪਾ ਰਹੇ ਹਨ ਜਿਵੇਂ ਕੋਈ ਮੋਰ ਪੈ ਪੈਲ ਪਾ ਰਿਹਾ ਹੋਵੇ ਕੁਝ ਜਮੀਨ ਉੱਤੇ ਬੈਠ ਕੇ ਧਮਾਲ ਪਾ ਰਹੇ ਹਨ ਜਿਵੇਂ ਕੋਈ ਬਾਜ ਸ਼ਿਕਾਰ ਕਰਨ ਲਈ ਝਪੱਟਾ ਮਾਰ ਰਿਹਾ ਹੋਵੇ ਢੋਲੀ ਤੇਜ ਰਫਤਾਰ ਢੋਲ ਵਜਾ ਰਿਹਾ ਹੈ ਜਿਸ ਨਾਲ ਸਾਰੇ ਗੱਭਰੂਆ ਵਿੱਚ ਹੋਰ ਜੋਸ਼ ਆ ਰਿਹਾ ਹੈ ਉਹ ਛਾਲਾ ਮਾਰ ਰਹੇ ਹਨ ਤੇ ਘੁੰਮ ਰਹੇ ਹਨ ਅਤੇ ਆਪਣੇ ਹੱਥਾਂ ਨੂੰ ਹਵਾ ਵਿੱਚ ਲਹਿਰਾ ਰਹੇ ਹਨ ਪੂਰਾ ਮਾਹੌਲ ਖੁਸ਼ੀ ਉੱਤੇ ਅਤੇ ਉਤਸ਼ਾਹ ਵਿੱਚ ਭਰਿਆ ਹੋਇਆ ਹੈ ਦਰਸ਼ਕ ਦੀ ਵੀ ਤਾੜੀਆਂ ਮਾਰ ਕੇ ਅਤੇ ਨਾਲ ਨਾਲ ਗਾ ਕੇ ਗੱਭਰੂਆਂ ਦਾ ਹੌਸਲਾ ਵਧਾ ਰਹੇ ਹਨ ਇਹ ਭੰਗੜਾ ਪੇਸ਼ ਪੇਸ਼ਕਾਰੀ ਸਿਰਫ ਇੱਕ ਨਾਚ ਨਹੀਂ ਸਗੋਂ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦਾ ਪ੍ਰਤੀਕ ਹੈ ਇਹ ਪੰਜਾਬੀਆਂ ਦੇ ਜੀਵਨ ਜੋਸ਼ ਅਤੇ ਖੁਸ਼ੀ ਦਾ ਪ੍ਰਗਟਾਵਾ ਹੈ